ਜੇ ਆਪਾਂ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਦਾ ਇਤਿਹਾਸ ਮੁਗਲ ਸਾਮਰਾਜ ਵੱਲ ਜ਼ਿਆਦਾ ਝੁਕਦਾ ਹੈ ਜਿਹੜਾ ਭਾਰਤ ਦਾ ਇਤਿਹਾਸ ਦਾ ਸਭ ਤੋਂ ਜ਼ਿਆਦਾ ਇਨਪੈਕਟ ਆਪਾਂ ਨੂੰ ਵੇਖਣ ਨੂੰ ਮਿਲਦਾ ਤਾਂ ਉਹ ਮੁਗਲਾਂ ਦਾ ਇਤਿਹਾਸ ਆਪਾਂ ਨੂੰ ਜ਼ਿਆਦਾ ਵੇਖਣ ਨੂੰ ਮਿਲਦਾ ਜਿਹੜਾ ਮੁਗਲ ਇੰਪਾਇਰ ਸੀ ਉਹਦਾ ਜਿਹੜਾ ਫਾਊਂਡਰ ਸੀ ਜਾਂ ਜਿਹੜਾ ਸੰਸਥਾਪਕ ਸੀ ਉਹ ਬਾਬਰ ਸੀ ਜੋ ਕਿ ਅਤੇ ਮੂਡ ਦਾ ਸ਼ ਸ਼ਾਸਕ ਸੀ ਉਸਨੇ ਪੰਦਰ੍ਹਾਂ ਸੌ ਛੱਬੀ ਈਸਵੀ ਵਿੱਚ ਬੈਟਲ ਆਫ ਜਾਂ ਲੜਾਈ ਜਾਂ ਸੋ ਪਾਨੀਪਤ ਦੀ ਲੜਾਈ ਦੇ ਕਾਰਨ ਉਹ ਭਾਰਤ ਵਿੱਚ ਆਇਆ ਅਤੇ ਉਹਨੇ ਆਪਣਾ ਮੁਗਲ ਰਾਜ ਸਥਾਪਿਤ ਕੀਤਾ ਉਸ ਤੋਂ ਬਾਅਦ ਉਹਦਾ ਜਿਹੜਾ ਵੰਸ਼ਕ ਸੀ ਸ਼ਾ ਉਹਦਾ ਜਿਹੜਾ ਬੇਟਾ ਸੀ ਹਿਮਾਯੂ ਹਿਮਾਯੂ ਦਾ ਬੇਟਾ ਉਹ ਤੋਂ ਅੱਗੇ ਹਿਮਾਯੂ ਹਿਮਾਯੂ ਤੋਂ ਬਾਅਦ ਸ਼ਾਹਜਹਾਂ ਆਇਆ ਸ਼ਾਹਜਹਾਂ ਨੇ ਪੰ ਭਾਰਤ ਦੇ ਵਿੱਚ ਬਹੁਤ ਚੀਜ਼ਾਂ ਨੂੰ ਚੇ ਬਦ ਬਦਲਾਅ ਕੀਤਾ ਉਸਨੇ ਆਪਣੀ ਪਤਨੀ ਦੇ ਲਈ ਆਗਰਾ ਵਿੱਚ ਤਾਜ ਮਹਿਲ ਬਣਵਾਇਆ ਉਸ ਤੋਂ ਬਾਅਦ ਲਾਲ ਕਿਲ੍ਹਾ ਵੀ ਮੁਗਲ ਦੇ ਸਮੇਂ ਦੀ ਇੱਕ ਇਤਿਹਾਸਿਕ ਸਮਾਰਕ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਮੁਗਲ ਕਾਲ ਦਾ ਜਿਹੜਾ ਸਭ ਤੋਂ ਵੱਡਾ ਸ਼ਾਸਕ ਮੰਨਿਆ ਗਿਆ ਉਹ ਔਰੰਗਜ਼ੇਬ ਮੰਨਿਆ ਗਿਆ ਹੈ ਜਿਹਨੇ ਪੰਜਾਬ ਦੇ ਉੱਤੇ ਵੀ ਬਹੁਤ ਉਹਦਾ ਇੰਪੈਕਟ ਮਿਲਦਾ ਹੈ ਸ਼ ਸ਼ਾਹਜਹਾਂ ਦਾ ਬੇਟਾ ਸ਼ਾਹਜਹਾਂ ਤੋਂ ਬਾਅਦ ਦਾਰਾ ਸ਼ਿਕੋਹ ਵੀ ਆਇਆ ਦਾਰਾ ਸ਼ਿਕੋਹ ਤੋਂ ਬਾਅਦ ਔਰੰਗਜ਼ੇਬ ਨੂੰ ਆਪਾਂ ਮੰਨਦੇ ਹਾਂ ਬਈ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਦਾ ਕਾਰਨ ਬਣੇ ਉਹ ਅਤੇ ਸਭ ਤੋਂ ਜ਼ਿਆਦਾ ਕੱਟੜ ਜਿਹੜਾ ਮੁਸਲਿਮ ਮੰਨਿਆ ਗਿਆ ਹੈ ਉਹ ਔਰੰਗਜ਼ੇਬ ਮੰਨਿਆ ਗਿਆ ਹੈ ਜਿਸ ਨੇ ਕਈ ਹਿੰਦੂ ਧਰਮ ਦੇ ਜਿਹੜੇ ਮੰਦਰ ਹੈ ਉਹ ਤੁੜਵਾਏ ਅਤੇ ਦਰਗਾਹਾਂ ਮੁਸਲਿਮ ਦਰਗਾਹਾਂ ਬਣਵਾਈਆਂ ਜਿਹਦੇ ਕਰਕੇ ਉਹ ਥੋੜ੍ਹਾ ਜ਼ਿਆਦਾ ਵੱਡਾ ਸ਼ਾਸਕ ਮੰਨਿਆ ਗਿਆ ਹੈ ਮੁਗਲ ਸਾਮਰਾਜ ਦਾ ਸਭ ਤੋਂ ਵੱਡਾ ਸ਼ਾਸਕ ਮੰਨਿਆ ਗਿਆ ਬਟ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਜਿਹੜਾ ਮੁਗਲ ਸਾਮਰਾਜ ਦਾ ਜਿਹੜਾ ਮੁਗਲ ਸਮਰਾਜਯ ਸੀਗਾ ਉਹ ਥੋੜ੍ਹਾ ਜਿਹਾ ਥੱਲੇ ਨੂੰ ਆਇਆ ਉਸ ਤੋਂ ਬਾਅਦ ਇੰਨੇ ਪ੍ਰਭਾਵਸ਼ਾਲੀ ਆਪਾਂ ਨੂੰ ਸ਼ਾਸਕ ਦੇਖਣ ਨੂੰ ਨਹੀਂ ਮਿਲੇ ਬਟ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਜੋ ਸ ਮੁਗਲ ਪ੍ਰਸ਼ਾਸਕ ਸੀਗਾ ਜਿਹੜਾ ਮੁਗਲ ਸਮਰਾਜਯ ਸੀਗਾ ਉਹ ਪੰਜਾਬ ਜਾਂ ਭਾਰਤ ਦੀ ਰਾਜਨੀਤੀ ਭਾਰਤ ਦੇ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਉੱਭਰ ਕੇ ਆਇਆ ਹੈ ਜੀ